ਤੋਤਾ ਇੱਕ ਅਜਿਹਾ ਪੰਛੀ ਹੈ ਜੋ ਕਿ ਬੋਲ ਸਕਦਾ ਹੈ ਅਤੇ ਸਾਡੀ ਭਾਸ਼ਾ ਨੂੰ ਸਮਝ ਸਕਦਾ ਹੈ ਉਹ ਬਹੁਤ ਘਰਾਂ ਵਿੱਚ ਰੱਖਿਆ ਜਾਂਦਾ ਹੈ ਬਹੁਤ ਜੇ ਲੋਕ ਤੋਤੇ ਨੂੰ ਘਰ ਘਰ ਵਿੱਚ ਪਾਲਦੇ ਹਨ ਅਤੇ ਉਸ ਨੂੰ ਵੱਖਰੇ ਵੱਖਰੀਆਂ ਚੀਜ਼ਾਂ ਸਿਖਾਉਂਦੇ ਹਨ ਤੋਤਾ ਜ਼ਿਆਦਾ ਗਰ ਮਿਰਚੀ ਖਾਣੀ ਹੈ ਰਾਮ ਰਾਮ ਸੀਤਾ ਰਾਮ ਰਾਧੇ ਰਾਧੇ ਸ਼ਾਮ ਰਾਧੇ ਇਹ ਚੀਜ਼ਾਂ ਬਹੁਤ ਜ਼ਿਆਦਾ ਬੋਲਦੇ ਹਨ ਉਹਨਾਂ ਦੇ ਮੁੱਖ ਨੂੰ ਜਦੋਂ ਤੁਸੀਂ ਦੇਖੋਗੇ ਅਤੇ ਉਨ ਉਸ ਨੂੰ ਕੁਛ ਵੀ ਪੁੱਛੋਗੇ ਕਿ ਇਹ ਬੋਲ ਕੇ ਦਿਖਾ ਅਤੇ ਉਹ ਜ਼ਿਆਦਾਗਰ ਰਾਮ ਰਾਮ ਬੋਲੇਗਾ ਜਾਂ ਫਿਰ ਤੋਤਾ ਤੋਤਾ ਬੋਲੇਗਾ ਮੈਨਾ ਮੈਨਾ ਬੋਲੇਗਾ ਇਹੀ ਪੰਛੀ ਬੋਲ ਵੀ ਸਕਦਾ ਹੈ ਅਤੇ ਸਾਡੀ ਭਾਸ਼ਾ ਨੂੰ ਸਮਝ ਵੀ ਸਕਦਾ ਹੈ ਤੋਤਾ ਹੀ ਹੈ ਜੋ ਕਿ ਅਜਿਹਾ ਬੋਲ ਸਕਦਾ ਹੈ ਵਧੇਰੇ ਜਾਨਵਰ ਇਹ ਪ੍ਰਕਿ ਪ੍ਰਕਿਰਿਆ ਨਹੀਂ ਕਰ ਸਕਦੇ ਤੋਤਾ ਹੀ ਹੈ ਜੋ ਕਿ ਇਹ ਪ੍ਰਕਿਰਿਆ ਕਰ ਸਕਦਾ ਹੈ ਉਹੀ ਹੈ ਜੋ ਸਾਡੇ ਬੋਲਣ 'ਤੇ ਉਸਨੂੰ ਦੁਬਾਰਾ ਬੋਲ ਕੇ ਦਿਖਾਉਂਦਾ ਹੈ ਹੋਰ ਵੀ ਕਈ ਲੋਕ ਉਸ ਨੂੰ ਹੋਰ ਤਰ੍ਹਾਂ ਦੀਆਂ ਵੀ ਚੀਜ਼ਾਂ ਸਿਖਾਉਂਦੇ ਹਨ ਜਿਵੇਂ ਕਿ ਇਸ਼ਾਰਾ ਕਰਨਾ ਜਾਂ ਫਿਰ ਹੋਰ ਚੀਜ਼ਾਂ ਬੋਲਣੀਆਂ